ਅਸੀਂ ਖਾਣਾ ਪਕਾਉਣ ਸਮੇਂ ਆਪਣੀ ਰਸੋਈ ਵਿੱਚ ਕਾਫ਼ੀ ਸਾਰੇ ਜੜੀ ਬੂਟੀਆਂ ਦਾ ਪ੍ਰਯੋਗ ਕਰਦੇ ਹਾਂ ਜਿਨ੍ਹਾਂ ਵਿੱਚੋਂ ਇੱਕ ਹੈ ਕੜ੍ਹੀ ਪੱਤਾ ਕੜ੍ਹੀ ਪੱਤਾ ਸਾਡੇ ਕਲੈਸਟਰੋਲ ਅਤੇ ਬੀਪੀ ਨੂੰ ਕੰਟਰੋਲ ਰੱਖਦਾ ਹੈ ਅਤੇ ਇਹ ਬਹੁਤ ਸਾਰੀ ਹੋਰ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਲਸਣ ਖਾਲੀ ਪੇਟ ਲੈਣ ਨਾਲ਼ ਲਸ ਬੀਪੀ ਕੰਟਰੋਲ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਨੂੰ ਠੀਕ ਰੱਖਦਾ ਹੈ ਐਵੇਂ ਹੀ ਗਿਲੋ ਤੁਲਸੀ ਅਤੇ ਐਲੋਵੀਰਾ ਆਦਿ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਸੈੱਲ ਘੱਟਣ ਨਾਲ ਜਾਂ ਡੇਂਗੂ ਵਗੈਰਾ ਬੁਖ਼ਾਰ ਤੋਂ ਇਨਫੈਕਸ਼ਨ ਤੋਂ ਠੀਕ ਰਹਿੰਦਾ ਹੈ ਅਤੇ ਪੁਦੀਨਾ ਜਿਹੜਾ ਹੈਗਾ ਇਹ ਆਪਣੇ ਹਾਜ਼ਮੇ ਲਈ ਬਹੁਤ ਹੀ ਵਧੀਆ ਹੁੰਦਾ ਹੈ ਪੁਦੀਨੇ ਦੀ ਵਰਤੋਂ ਕਰਦੇ ਹਾਂ ਅਸੀਂ ਆਪਣੇ ਰਸੋਈ ਵਿੱਚ ਜਦੋਂ ਚਟਨੀ ਵਗੈਰਾ 'ਚ ਪ੍ਰਯੋਗ ਹੋ ਸਕਦਾ ਹੈ ਇਹਦਾ ਅਤੇ ਕੁਝ ਸ਼ਿਕੰਜਵੀ ਵਗੈਰਾ ਨਿੰਬੂ ਪਾਣੀ ਬਣਾਉਂਦੇ ਹਾਂ ਤਾਂ ਆਪਾਂ ਪੁਦੀਨਾ ਪਾ ਕੇ ਇਸ ਨਾਲ ਜਿਹੜਾ ਹੈ ਕਿ ਆਪਣਾ ਹਾਜ਼ਮਾ ਠੀਕ ਰਹਿੰਦਾ ਹੈ ਅਤੇ ਕਿਸੇ ਠੰਡਕ ਦਿੰਦਾ ਹੈ ਅਤੇ ਜਿਹੜੇ ਮਸਾਲੇ ਹਨ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਦਵਾਈਆਂ ਦਾ ਜਿਹੜਾ ਹੈਗਾ ਲਾਭ ਦਿੰਦੇ ਹਨ ਇਹ ਅੰਗਰੇਜ਼ੀ ਦਵਾਈਆਂ ਨਾਲੋਂ ਜ਼ਿਆਦਾ ਬੈਟਰ ਹਨ ਜਿਹੜੇ ਕਿ ਨਾ ਤਾਂ ਇਹਨਾਂ ਦੇ ਸਾਈਡ ਇਫੈਕਟ ਹੁੰਦੇ ਹੈ ਅਤੇ ਇਹਨਾਂ ਨੂੰ ਲੈਣ ਨਾਲ ਸਾਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਅਤੇ ਸਗੋਂ ਸਰੀਰ ਤੰਦਰੁਸਤ ਰਹਿੰਦਾ ਹੈ